ਹਾਂਜੀ ਵੀਰ ਕੀ ਹਾਲ ਹੈ ਸਿੱਧੂ ਬੋਲਦਾ ਵੀਰੇ ਜਸਪ੍ਰੀਤ ਬੋਲਦਾ ਵੀਰੇ ਬੜੀ ਹਵੇਲੀ ਤੋਂ ਅਤੇ ਸਮਾਨ ਹੋਟਲ ਤੋਂ ਦੋ ਬਰਗਰ ਸੀਗੇ ਤਿੰਨ ਟਿੱਕੀਆਂ ਸੀਗੀਆਂ ਅਤੇ ਆਪਣਾ ਐਡਰੈਸ ਨਾ ਆਪਣਾ ਮੈਂ ਦਿੱਤਾ ਸੀ ਬੜੀ ਹਵੇਲੀ ਦਾ ਘਰ ਦਾ ਅਤੇ ਉੱਥੇ ਨਾ ਲੈ ਕੇ ਆਇਓ ਕਿਉਂਕਿ ਉਹ ਐਡਰੈਸ ਚੇਂਜ ਵੀ ਕੀਤਾ ਸੀ ਪਰ ਹੋਇਆ ਨਹੀਂ 'ਤੇ ਵੀ ਬੰਦਾ ਡਿਲਵਰੀ ਵਾਲਾ ਪਹੁੰਚਿਆ ਨਹੀਂ ਹੈਗਾ ਗਲਤ ਸਹੀ ਐਡਰੈਸ 'ਤੇ ਉਹ ਹੁਣ ਪਹਿਲਾਂ ਐਡਰੈਸ 'ਤੇ ਪਹੁੰਚ ਗਿਆ ਉਹਨੂੰ ਮਾੜਾ ਜਿਹਾ ਦੱਸਿਓ ਵੀ ਇਹ ਉਹਨੂੰ ਮਤਲਬ ਦੇ ਕੋਲ ਮੇਨ ਗੇਟ 'ਤੇ ਖੜ੍ਹ ਜਾਵੇ ਆ ਕੇ